ਹੈਲੋ ਹਾਂ ਭਾਈ ਢਿੱਲੋ ਭਰਾਵਾਂ ਦੇ ਢਾਬੇ ਤੋਂ ਬੋਲ ਰਹੇ ਹੋ ਹਾਂ ਸਤਿ ਸ਼੍ਰੀ ਅਕਾਲ ਬਾਈ ਹਾਂ ਬਾਈ ਆਪਾਂ ਨਾ ਪਿਛਲੇ ਹਫ਼ਤੇ ਇੱਕ ਆਰਡਰ ਦਿੱਤਾ ਸੀਗਾ ਹਾਂ ਦੋ ਬੰਦਿਆਂ ਦਾ ਜਿਹੜਾ ਖਾਣਾ ਆਰਡਰ ਕੀਤਾ ਸੀਗਾ ਫਿਰ ਮੈਂ ਕੈਂਸਲ ਪਾਤਾ ਸੀ ਉਹ ਹਾਂ ਪਰ ਬਾਈ ਉਹਦਾ ਰਿਫੰਡ ਨਹੀਂ ਹੈ ਜਿਹੜਾ ਤੁਹਾਡਾ ਖ਼ਰਚਾ ਕੱਟਣਾ ਸੀ ਤੁਸੀਂ ਮੈਂ ਆਪਣੀ ਗੱਲ ਵੀ ਹੋਈ ਸੀ ਉਹਦੇ ਬਾਰੇ ਵੀ ਤੁਸੀਂ ਆਪਣਾ ਖ਼ਰਚਾ ਕੱਟ ਕੇ ਬਾਕੀ ਜਿਹੜੇ ਮੇਰੇ ਬਣਦੇ ਪੈਸੇ ਉਹ ਮੈਨੂੰ ਵਾਪਿਸ ਮੇਰੇ ਅਕਾਊਂਟ 'ਚ ਜਿਹੜੇ ਪਾ ਦਿਓ ਹਾਂ ਪਰ ਬਾਈ ਹਜੇ ਤੱਕ ਆਏ ਨਹੀਂ ਇੱਕ ਹਫ਼ਤੇ ਹੋ ਗਿਆ ਇਹ ਸਮੱਸਿਆ ਕੀ ਹੈ ਮਤਲਬ ਕੋਈ ਤਾਂ ਪ੍ਰੋਬਲਮ ਹੋਵੇਗੀ ਜਿਹੜੇ ਆ ਨਹੀਂ ਰਹੀ ਹਾਂ ਮੇਰੇ ਕੋਲ ਹੈਗਾ ਆਰਡਰ ਨੰਬਰ ਹਾਂ ਆਪਣਾ ਆਰਡਰ ਨੰਬਰ ਲਿਖ ਲਓ ਚੁਰਾਨਵੇਂ ਛੇ ਸੌ ਬੱਤੀ ਹਾਂ ਬਿਆਲੀ ਬਿਆਲੀ ਸੱਤ ਸੌ ਨੌਂ ਹਾਂ ਚੁਰਾਨਵੇਂ ਛੇ ਸੌ ਬੱਤੀ ਬਿਆਲੀ ਬਿਆਲੀ ਸੱਤ ਸੌ ਨੌਂ ਹਾਂ ਇਹ ਆਪਣਾ ਆਰਡਰ ਨੰਬਰ ਸੀਗਾ ਹਾਂ ਦੋ ਬੰਦਿਆਂ ਦਾ ਲੰਚ ਆਡਰ ਕੀਤਾ ਸੀ ਅੱਠ ਸੌ ਪੰਜਾਹ ਰੁਪਏ ਹਾਂ ਅੱਠ ਸੌ ਪੰਜਾਹ ਰੁਪਏ ਜਿਹੜੇ ਉਹ ਮੈਂ ਬੈਲੈਂਸ ਕਰਤਾ ਸੀ ਬਾਅਦ 'ਚ ਕੈਂਸਲ ਕਰਤਾ ਸੀ ਹਾਂ ਤੁਸੀਂ ਆਪਣਾ ਜਿੰਨਾ ਤੁਹਾਡਾ ਬਣਦਾ ਦਸ ਜਾਂ ਵੀਹ ਪਰਸੈਂਟ ਕੱਟ ਕੇ ਮੇਰੇ ਵਾਪਿਸ ਬਾਕੀ ਕਰਨ ਦਾ ਗੱਲ ਹੋਈ ਸੀ ਤੁਸੀਂ ਉਹ ਕੀਤੇ ਨਹੀਂ ਹਜੇ ਹਾਂ ਠੀਕ ਹੈ ਬਾਈ ਓ ਕਰ ਦਿਓ ਠੀਕ ਹੈ ਜੀ ਹਾਂ ਕੱਲ੍ਹ ਸ਼ਾਮ ਤੱਕ ਹਾਂ ਠੀਕ ਹੈ ਠੀਕ ਹੈ ਓਕੇ ਠੀਕ ਹੈ ਸ਼ਾਮ ਤੱਕ ਕੱਲ੍ਹ ਕਰ ਦਿਓ ਜ਼ਰੂਰ ਬਾਈ